ਰੈਡ ਕਲਰ ਦੀ ਲੈਣੀ ਸੀ ਫਿਰ ਮੈਂ ਸਰਚ ਕੀਤਾ ਅਤੇ ਬਹੁਤ ਸਾਰੀਆਂ ਆਈਆਂ ਅਤੇ ਉੱਥੇ ਅਲੱਗ ਅਲੱਗ ਪ੍ਰਾਈਜ਼ ਵੀ ਸੀ ਅਤੇ ਮੈਨੂੰ ਰੈਡ ਕਲਰ ਦੀ ਲੈਣੀ ਸੀ ਫਿਰ ਮੈਂ ਉਹ ਸਿਲੈਕਟ ਕੀਤੀ ਅਤੇ ਉਸ ਨੂੰ ਆਰਡਰ ਕੀਤਾ ਅਤੇ ਕੈਸ਼ ਔਨ ਡਿਲੀਵਰੀ ਕੀਤਾ